ਹੈਲੋ ਕਰਨ ਬੋਲਦੇ ਪਏ ਕਰਨ ਮੈਂ ਹਾ ਕਰਨ ਬੋਲਦੇ ਪਏ ਕਰਨ ਵਧੀਆ ਵੀਰ ਤੂੰ ਸੁਣਾ ਮੈਂ ਕਿਹਾ ਪਛਾਣ ਹੀ ਲਿਆ ਕਿਤੇ ਪਛਾਣਨਾ ਨਹੀਂ ਤੈਂ ਹਾਂਜੀ ਹਾਂਜੀ ਚਲੋ ਮੈਂ ਹੋਰ ਫਿਰ ਕੀ ਹਾਲ ਚਾਲ ਵਧੀਆ ਹੁਣ ਕੀ ਕਰਦੇ ਹੁੰਦੇ ਅੱਜ ਕੱਲ੍ਹ ਅੱਛਾ ਅੱਛਾ ਪੋਲੋਟੈਕਨੀਕਲ ਹਾਂ ਮੈਂ ਵੀ ਤੁਹਾਨੂੰ ਇਸੇ ਬਾਰੇ ਪੁੱਛਣਾ ਸੀ ਕਿ ਮਤਲਬ ਪੋਲੋਟੈਕਨੀਕਲ ਹੀ ਪੜ੍ਹਦੇ ਪਏ ਤਾਂ ਹੈਗਾ ਅੱਛਾ ਅਤੇ ਉੱਥੇ ਸਕੋਲਰਸ਼ਿਪ ਦਾ ਵਗੈਰਾ ਦਾ ਕੀ ਹਿਸਾਬ ਕਿਤਾਬ ਆ ਮਤਲਬ ਜਾਂ ਆਪਾਂ ਐਡਮਿਸ਼ਨ ਲੈਣੀ ਹੋਵੇ ਤਾਂ ਮਤਲਬ ਕੀ ਹਿਸਾਬ ਕਿਤਾਬ ਹੈਗਾ ਦਾ ਪ੍ਰੋਸੈੱਸ ਕੀ ਹੈਗਾ ਹਾਂਜੀ ਹਾਂਜੀ ਹਮ ਹਮ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅਤੇ ਜਿਹੜੇ ਮੇਰੇ ਵਰਗੇ ਗ਼ਰੀਬ ਹੈਗੇ ਬੀਸੀ ਉਹ ਹਾਂਜੀ ਹਾਂਜੀ ਠੀਕ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਮੈਂ ਇਹੋ ਪੁੱਛਣਾ ਸੀ ਨਾ ਤੁਸੀਂ ਉੱਥੇ ਪੜ੍ਹਦੇ ਪਏ ਜੋ ਅਤੇ ਮੈਂ ਵੀ ਮਤਲਬ ਉੱਥੇ ਐਡਮਿਸ਼ਨ ਲਵਾਂ ਵੀ ਸੈੱਟ ਹੈ ਕਿ ਨਹੀਂ ਪੜ੍ਹਾਉਂਦੇ ਆ ਸਕੂਲ ਪੜ੍ਹਾਈ ਪੜੁਈ ਤਾਂ ਵੈਸੇ ਹੁੰਦੀ ਹੋਣੀ ਹੈ ਨਾ ਸੁਣਿਆ ਵਾਹਵਾ ਨਾਮ ਸਕੂਲ ਦਾ ਅੱਛਾ ਠੀਕ ਹੈ ਚਲੋ ਠੀਕ ਹੈ ਕੋਈ ਨਹੀਂ ਮਤਲਬ ਵਧੀਆ ਹੈਗਾ ਨਾ ਬਿਲਕੁਲ ਕੁੱਲ ਮਿਲਾ ਕੇ ਵਧੀਆ ਹੈਗਾ ਨਾ ਸਕੂਲ ਮਤਲਬ ਠੀਕ ਆ ਚਲੋ ਠੀਕ ਆ ਕੋਈ ਨਹੀਂ ਥੈਂਕ ਯੂ